ਮੈਂ ਸਪੋਟੀਫਾਈ ਐਪ 'ਤੇ ਇੱਕ ਕਹਾਣੀ ਪੜ੍ਹੀ ਸੀ ਜਿਸ ਵਿੱਚ ਚਾਰ ਭੈਣਾਂ ਮਾਂ ਤੋਂ ਵਾਂਝੀਆਂ ਸਨ ਅਤੇ ਉਨ੍ਹਾਂ ਦਾ ਪਿਓ ਉਨ੍ਹਾਂ ਦਾ ਪਾਲਣ ਪੋਸ਼ਣ ਕਰਦਾ ਸੀ ਕੁੜੀਆਂ ਦੇ ਵੱਡੇ ਹੋਣ 'ਤੇ ਅਤੇ ਵਿਆਹੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਛੋਟੀ ਭੈਣ ਇਕੱਲੀ ਬਾਪ ਨਾਲ ਪਿੰਡ ਵਿੱਚ ਰਹਿ ਰਹੀ ਸੀ ਅਤੇ ਉਸ ਨਾਲ ਖੇਤੀਬਾੜੀ ਅਤੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਸੀ ਉਸ ਦਾ ਪਿਓ ਹੀ ਉਸ ਦੇ ਸਿਰ ਦਾ ਧੋਣਾ ਆਦਿ ਕੰਮਕਾਰ ਕਰਦਾ ਹੁੰਦਾ ਸੀ ਇੱਕ ਦਿਨ ਅਚਾਨਕ ਉਸ ਦਾ ਪਿਓ ਖੇਤੋਂ ਮੁੜ ਨਹੀਂ ਪਰਤਦਾ ਤਾਂ ਉਹ ਇੱਧਰ ਉੱਧਰ ਦੇਖਦੀ ਹੈ ਤਾਂ ਇੱਕ ਦਿਨ ਜਦੋਂ ਉਹ ਲੱਭਦੀ ਹੋਈ ਖੇਤ ਵਿੱਚ ਪੁੱਜਦੀ ਹੈ ਤਾਂ ਉਸ ਦੇ ਪਿਓ ਦੀ ਕਰੰਟ ਲੱਗਣ ਨਾਲ ਮੌਤ ਗਈ ਮੌਤ ਹੋ ਗਈ ਹੁੰਦੀ ਹੈ ਉਹ ਇਹ ਸਭ ਦੇਖ ਕੇ ਇਹ ਸਹਿਣ ਨਹੀਂ ਕਰ ਪਾਉਂਦੀ ਜਦੋਂ ਉਹ ਚਾਰੋਂ ਭੈਣਾਂ ਇਕੱਠੀਆਂ ਹੁੰਦੀਆਂ ਹਨ ਅਤੇ ਬਾਪ ਦਾ ਸੰਸਕਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਪਿੰਡ ਦੀ ਜੂਹ ਉਨ੍ਹਾਂ ਲਈ ਪਿਆ ਉਨ੍ਹਾਂ ਲਈ ਪਰਾਈ ਹੋ ਜਾਂਦੀ ਹੈ ਉਹ ਲਗਾਤਾਰ ਉਸ ਪਿੰਡ ਦੇ ਵਿਚਲੇ ਦਰੱਖਤਾਂ ਆਪਣੇ ਪਿੰ ਘਰ ਵਿਚਲੀ ਲੱਗੀ ਨਿੰਮ ਆਪਣੇ ਮਾਂ ਦੇ ਹੱਥਾਂ ਦੇ ਟਰੰਕਾਂ ਪੇਟੀਆਂ ਵਿਹੜੇ ਵਿਚਲੀ ਨਿੰਮ ਨੂੰ ਦੇਖਦੀਆਂ ਹੋਈਆਂ ਹੋਂਕੇ ਭਰਦੀਆਂ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਫਿਰ ਛੋਟੀ ਭੈਣ ਦਾ ਵੀ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਇਹ ਦਰਦਨਾਕ ਕਹਾਣੀ ਨੂੰ ਪੜ੍ਹ ਕੇ ਮੈਨੂੰ ਬਹੁਤ ਰੋਣਾ ਆਇਆ